ਮੈਂ ਅਮਨਦੀਪ ਕੌਰ ਰੈਲ ਮਾਜਰੇ ਤੋਂ ਸਾਡੇ ਕ ਇੱਕ ਦਿਨ ਖਰਾਬ ਮੌਸਮ ਸੀ ਕਾਫੀ ਸਾਡੇ ਘਰ ਅਚਾਨਕ ਮਹਿਮਾਨ ਆ ਗਏ ਸਾਡੇ ਸਿਲੰਡਰ ਵੀ ਖਤਮ ਸੀ ਇਸ ਕਰਕੇ ਮੈਂ ਰੋਟੀ ਨਹੀਂ ਬਣਾ ਪਾ ਰਹੀ ਸੀ ਸਾਡੇ ਤੋਂ ਕੁਛ ਹੀ ਦੂਰੀ 'ਤੇ ਪ੍ਰੀਤ ਡੈਲੈਕਸ ਢਾਬਾ ਹੈ ਮੈਂ ਉੱਥੇ ਰੋਟੀ ਦਾ ਔਡਰ ਕੀਤਾ ਜਿਸ ਤਰ੍ਹਾਂ ਕਿ ਦਾਲ ਮੱਖਣੀ ਦਾਲ ਮੱਖਣੀ ਸ਼ਾਹੀ ਪਨੀਰ ਰਾਇਤਾ ਚੌਲ ਸਲਾਦ ਫੁਲਕੇ ਉਤੋਂ ਤੇ ਉਥੋਂ ਦੇ ਮੈਨੇਜਰ ਨੇ ਬਹੁਤ ਵਧੀਆ ਤਰੀਕੇ ਨਾਲ ਰੋਟੀ ਮਤਲਬ ਕਿ ਡਿਲੀਵਰੀ ਬੋਆਏ ਹੱਥ ਸਾਡੇ ਘਰ ਰੋਟੀ ਪਹੁੰਚਾਈ ਜੋ ਕਿ ਰੋਟੀ ਖਾਣਾ ਅਸੀਂ ਕੋਲ ਕਾਫੀ ਮੌਸਮ ਖਰਾਬ ਕਰਕੇ ਵੀ ਡਿਲੀਵਰੀ ਬੋਆਏ ਨੇ ਕਾਫੀ ਟਾਈਮ 'ਤੇ ਸਾਡੇ ਘਰ ਰੋਟੀ ਪਹੁੰਚਾ ਦਿੱਤੀ ਜਦ ਅਸੀਂ ਰੋਟੀ ਖਾਧੀ ਰ ਖਾਣਾ ਬਹੁਤ ਟੇਸਟੀ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸੀ ਇਸ ਲਈ ਅਸੀਂ ਡਿਲੀਵਰੀ ਬੋਆਏ ਦਾ ਅਤੇ ਮੈਨੇਜਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ